ਇੱਕ ਖੂਹ ਵਿੱਚੋਂ ਪਾਣੀ ਕੱਢਣ ਦੇ ਬਹੁਤ ਸਾਰੇ ਤਰੀਕੇ ਹਨ ਜਿਵੇਂ ਕਿ ਸਾਨੂੰ ਪਹਿਲਾਂ ਤਾਂ ਇਹ ਪਤਾ ਕਰਨਾ ਪਵੇਗਾ ਕਿ ਖੂਹ ਕਿਸ ਪ੍ਰਕਾਰ ਦਾ ਹੈ ਸਾਡਾ ਖੂਹ ਚੌੜਾ ਹੈ ਜਾਂ ਮੀਡੀਅਮ ਸਾਈਜ਼ ਦਾ ਹੈ ਜਾਂ ਜ਼ਿਆਦਾ ਹੀ ਬਰੀਕ ਹੈ ਸਭ ਤੋਂ ਪਹਿਲਾਂ ਤਾਂ ਜਿਹੜਾ ਵੀ ਸਾਡਾ ਚੌੜਾ ਖੂਹ ਹੈ ਉਸ ਨੂੰ ਆਪਾਂ ਦੇਖਾਂਗੇ ਜਾਂ ਡੂੰਘਾ ਹੈ ਉਹ ਖੂਹ ਉਸ ਦੇ ਆਲੇ ਦੁਆਲੇ ਆਪਾਂ ਪੌੜੀਆਂ ਦੀ ਸਹਾਇਤਾ ਨਾਲ ਉਹਦੇ ਥੱਲੇ ਜਾ ਸਕਦੇ ਹਾਂ ਅਤੇ ਉਸ ਵਿੱਚੋਂ ਪਾਣੀ ਕੱਢ ਸਕਦੇ ਹਾਂ ਬਾਹਰ ਦੂਸਰੇ ਟਾਈਮ 'ਤੇ ਜੇ ਖੂਹ ਸਾਡਾ ਹੈਗਾ ਆ ਮੀਡੀਅਮ ਸਾਈਜ਼ ਦਾ ਫਿਰ ਆਪਾਂ ਉਸ ਨੂੰ ਬਾਲਟੀ ਦੀ ਸਹਾਇਤਾ ਨਾਲ ਰੱਸੀ ਲਮਕਾ ਕੇ ਕੋਈ ਜੁਗਾੜਮੈਂਟ ਕਰਕੇ ਉਹਦੇ ਅੰਦਰ ਬਾਲਟੀ ਪਾ ਕੇ ਅਤੇ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਪਾਣੀ ਕੱਢ ਸਕਦੇ ਹਾਂ ਪਰ ਇਸ ਨਾਲ ਸਾਨੂੰ ਬਲ ਦੀ ਜ਼ਰੂਰਤ ਪਵੇਗੀ ਜਿਹੜਾ ਕਿ ਆਮ ਔਰਤਾਂ ਕੋਲ ਜ਼ਿਆਦਾ ਬਲ ਨਹੀਂ ਹੁੰਦਾ ਸੋ ਅਸੀਂ ਇਸ ਤੋਂ ਬਚਣ ਲਈ ਅਸੀਂ ਇਲੈਕਟ੍ਰਿਕ ਮੋਟਰ ਦੀ ਵਰਤੋਂ ਕਰਾਂਗੇ ਜਿੱਦਾਂ ਕਿ ਸਾਡੇ ਕੋਲ ਆਮ ਘਰਾਂ ਵਿੱਚ ਕਈ ਜੁਗਾੜ ਹੁੰਦੇ ਹਨ ਜਿੱਦਾਂ ਕਿ ਆਪਾਂ ਇਲੈਕਟ੍ਰਿਕ ਮੋਟਰ ਲਗਾ ਕੇ ਕੋਈ ਜੁਗਾੜਮੈਂਟ ਲਗਾ ਕੇ ਪੰਨੀਆਂ ਲਗਾ ਕੇ ਜਿਹੜੀਆਂ ਅੰਦਰ ਜਾਂਦੀਆਂ ਹਨ ਅਤੇ ਪਾਣੀ ਉਸ ਦੌਰਾਨ ਬਾਹਰ ਆਉਂਦਾ ਹੈ ਇਸ ਤਰ੍ਹਾਂ ਆਪਾਂ ਬੜੇ ਸੌਖੇ ਤਰੀਕੇ ਨਾਲ ਖੂਹ ਵਿੱਚੋਂ ਪਾਣੀ ਕੱਢ ਸਕਦੇ ਹਾਂ